ਮੈਂ ਆਪਣੇ ਇਲਾਕੇ ਵਿੱਚ ਬਹੁਤ ਸਾ ਬਹੁਤ ਸਾਰੀਆਂ ਇਤਿਹਾਸਿਕ ਕਹਾਣੀਆਂ ਸੁਣੀਆਂ ਹਨ ਫਤਿਹਗੜ੍ਹ ਸਾਹਿਬ ਦੇ ਵਿੱਚ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਛੋਟੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਆਪਣੇ ਹੱਥੀਂ ਦੁੱਧ ਪਿਲਾਇਆ ਸੀ ਅਤੇ ਵਜ਼ੀਰ ਖਾਨ ਨੇ ਉਹਨਾਂ ਨੂੰ ਸਰਹੰ ਫਤਿਹਗੜ੍ਹ ਦੇ ਵਿੱਚ ਫਤਿਹਗੜ੍ਹ ਦੇ ਪੁਰਾ ਪੁਰਾਣਾ ਫਤਿਹਗੜ੍ਹ ਦਾ ਨਾਮ ਸਰਹੰਦ ਸੀ ਅਤੇ ਉਹਨਾਂ ਨੇ ਉਹਨਾਂ ਨੂੰ ਉਸ ਵਿੱਚ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਸੀ ਤਾਂ ਜੋ ਕਿ ਇਹ ਸਾਡਾ ਧਰਮ ਮੰਨ ਸਕਣ ਪਰ ਸਿੱ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੇ ਨਾ ਮੰਨਦੇ ਹੋਏ ਆਪਣਾ ਧਰਮ ਵਾਰ ਦਿੱਤਾ ਪਰ ਉਹਨਾਂ ਦੇ ਧਰਮ ਨੂੰ ਸਵੀਕਾਰ ਨਹੀਂ ਕੀਤਾ ਇਹ ਗੱਲਾਂ ਮੈਂ ਬਹੁਤ ਸ਼ੁਰੂ ਤੋਂ ਹੀ ਸੁਣਦੀ ਆ ਰਹੀ ਹਾਂ ਕਿ ਇਹ ਬਹੁਤ ਹੀ ਇਤਿਹਾਸਿਕ ਘਟਨਾਵਾਂ ਹਨ ਅਤੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਅ ਲੋਕ ਹਨ ਜਿਨ੍ਹਾਂ ਨੂੰ ਇਹਨਾਂ ਇਤਿਹਾਸਿਕ ਘਟਨਾਵਾਂ ਬਾਰੇ ਨਹੀਂ ਪਤਾ ਪਰ ਮੇਰੇ ਮਾਤਾ ਪਿਤਾ ਅਤੇ ਮੇਰੇ ਦਾਦਾ ਦਾਦੀ ਜੀ ਨੇ ਮੈਨੂੰ ਇਹਨਾਂ ਗੱਲਾਂ ਬਾਰੇ ਦੱਸਿਆ ਹੈ ਕਿ ਆਪਣੇ ਇੱਥੇ ਪਹਿਲਾਂ ਬਹੁਤ ਹੀ ਜ਼ੁਲਮ ਕੀਤਾ ਜਾਂਦਾ ਸੀ ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਜ਼ੁਲਮਾਂ ਦੀ ਆਵਾਜ਼ ਉਠਾਉਣ ਲਈ ਆਪਣੇ ਸਾਹਿਬਜ਼ਾਦਿਆਂ ਨੂੰ ਭੇਜਿਆ ਤਾਂ ਇੱਥੇ ਦੇ ਮੁਸਲਮਾਨ ਵਜ਼ੀਰ ਖਾਨ ਨੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਸੀ ਤਾਂ ਜੋ ਉਹ ਇਹਨਾਂ ਦੀਆਂ ਘਟ ਇਹਨਾਂ ਦਾ ਧਰਮ ਮੰਨ ਸਕਣ ਪਰ ਇਨ ਉਹਨਾਂ ਨੇ ਸਾਹਿਬਜ਼ਾਦਿਆਂ ਨੇ ਧਰਮ ਨਾ ਮੰਨਦੇ ਹੋਏ ਆਪਣਾ ਧਰਮ ਵਾਰ ਦਿੱਤਾ ਪਰ ਉਹਨਾਂ ਦੇ ਧਰਮ ਨੂੰ ਕਬੂਲਿਆ ਨਹੀਂ